ਸਤਿ ਸ਼੍ਰੀ ਅਕਾਲ ਜੀ ਮੈਂ ਵਿਸ਼ਾਲੀ ਸ਼ਰਮਾ ਜ਼ਿਲ੍ਹਾ ਨਿਵਾਸੀ ਪਠਾਨਕੋਟ ਤੋਂ ਬੋਲ ਰਹੀ ਹਾਂ ਅੱਜ ਮੈਂ ਤੁਹਾਡੇ ਨਾਲ ਸੈਰ ਸਪਾਟੇ ਨਾਲ ਸੰਬੰਧਿਤ ਆਪਣੇ ਕੁਝ ਵਿਚਾਰ ਸਾਂਝੇ ਕਰਾਂਗੀ ਸੈਰ ਸਪਾਟਾ ਸਾਡੇ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਸੈਰ ਕਰਨ ਨਾਲ ਅਸੀਂ ਨਿਰੋਗੀ ਰਹਿੰਦੇ ਹਾਂ ਪਰ ਅੱਜ ਕੱਲ੍ਹ ਦੇ ਜਦੋਂ ਵੀ ਲੋਕ ਸਪਾਟਾ ਕਰਨ ਜਾਂਦੇ ਹਨ ਉਹ ਤਾਂ ਵੀ ਫੋਨਾਂ ਨਾਲ ਹੀ ਲੱਗੇ ਹੁੰਦੇ ਹਨ ਇਸ ਲਈ ਕਈ ਵਾਰੀ ਕੋਈ ਦੁਰਘਟਨਾ ਵਾਪਰ ਸਕਦੀ ਹੈ ਸਾਡੇ ਅਤੇ ਅਸੀਂ ਕਿਸੇ ਐਕਸੀਡੈਂਟ ਜਾਂ ਸ਼ਿਕਾਰ ਹੋ ਸਕਦੇ ਹਾਂ ਸੈਰ ਕਰਦੇ ਸਮੇਂ ਜਦੋਂ ਅਸੀਂ ਫੋਨ ਦਾ ਇਸਤੇਮਾਲ ਕਰਦੇ ਹਾਂ ਤਾਂ ਕਈ ਵਾਰ ਸਾਡੇ ਕੋਲੋਂ ਸਾਡੇ ਕਈ ਜਾਣ ਪਹਿਚਾਣ ਦੇ ਲੋਕ ਸਾਡੇ ਦੋਸਤ ਲੰਘ ਜਾਂਦੇ ਹਨ ਤਾਂ ਸਾਨੂੰ ਪਤਾ ਵੀ ਨਹੀਂ ਲੱਗਦਾ ਕਿਸ ਨਾਲ ਸਾਡਾ ਭਾਈਚਾਰਾ ਪ੍ਰਭਾਵਿਤ ਹੁੰਦਾ ਹੈ ਇੰਝ ਕਰਨ ਨਾਲ ਕਈ ਵਾਰ ਸਾਡੇ ਕੁਝ ਦੋਸਤ ਗਵਾਂਢੀ ਆਦਿ ਸਾਡੇ ਤੋਂ ਨਰਾਜ਼ ਵੀ ਹੋ ਜਾਂਦੇ ਹਨ ਇਸ ਲਈ ਸਾਨੂੰ ਸੈਰ ਕਰਦੇ ਸਮੇਂ ਕਦੇ ਵੀ ਫੋਨ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਅਤੇ ਰਾਹ ਵਿੱਚ ਮਿਲਦੇ ਆਪਣੇ ਸਾਰੇ ਦੋਸਤਾਂ ਮਿੱਤਰਾਂ ਆਦਿ ਨੂੰ ਬੁਲਾਉਣਾ ਚਾਹੀਦਾ ਹੈ ਜਿਸ ਨਾਲ ਸਾਡਾ ਭਾਈਚਾਰਾ ਬਣਿਆ ਰਹੇ